ਹਾਂਜੀ ਮੈਂ ਆਪਣੀ ਲਾਈਫ ਵਿੱਚ ਇੱਕ ਯਾਦਗਾਰ ਯਾਤਰਾ 'ਤੇ ਗਈ ਜੰਮੂ ਕਸ਼ਮੀਰ ਦੇ ਲਾਗੇ ਇੱਕ ਵੈਸ਼ਨੋ ਦੇਵੀ ਦਾ ਮੰਦਰ ਹੈ ਉੱਥੇ ਮੈਂ ਗਈ ਉੱਥੇ ਬਹੁਤ ਜ਼ਿਆਦਾ ਚੌਦ੍ਹਾਂ ਕਿਲੋਮੀਟਰ ਦੀ ਚੜ੍ਹਾਈ ਹੈਗੀ ਹੈ ਉੱਥੇ ਬੜੇ ਚੜ੍ਹਾਈ ਚੜ੍ਹ ਕੇ ਜਾਣਾ ਚਾਹੀਦਾ ਬੜੇ ਸਾਹਸ ਨਾਲ ਮੈਂ ਗਈ ਪਰ ਮੈਂ ਕਈ ਉੱਥੇ ਲੋਕਾਂ ਨੂੰ ਵੇਖਿਆ ਕਈ ਘੋੜੇ ਗਧਿਆਂ 'ਤੇ ਚੜ੍ਹ ਕੇ ਜਾ ਰਹੇ ਆ ਅਤੇ ਪਰ ਬੇਜ਼ੁਬਾਨਾਂ ਜਾਨਵਰਾਂ 'ਤੇ ਸਾਨੂੰ ਚੜ੍ਹ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਆਪਾਂ ਗੁਰੂ ਘਰ ਜਾ ਰਹੇ ਹਾਂ ਆਪਾਂ ਚੜ੍ਹਾਈ ਚੜ੍ਹ ਕੇ ਆਰਾਮ ਨਾਲ ਸਾਹਸ ਨਾਲ ਚੜ੍ਹੀਏ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਡਰ ਇੱਕ ਮਨ 'ਚ ਟੀਚਾ ਇੱਕ ਨਿਸ਼ਚਾ ਹੋਣਾ ਚਾਹੀਦਾ ਕਿ ਜੇ ਆਪਾਂ ਗੁਰੂ ਘਰ ਜਾ ਰਹੇ ਹਾਂ ਇੱਕ ਮਾਤਾ ਦੇ ਮੰਦਰ 'ਚ ਜਾ ਰਹੇ ਹਾਂ ਅਤੇ ਆਪਾਂ ਆਰਾਮ ਨਾਲ ਸੰਤੁਸ਼ਟੀ ਨਾਲ ਚੜ੍ਹਾਈ ਚੜ੍ਹ ਕੇ ਜਾਈਏ ਹੌਲੀ ਹੌਲੀ ਜਾਈਏ ਜੇ ਆਪਾਂ ਸਾਡੇ ਮਨ 'ਚ ਨਿਸ਼ਚਾ ਏ ਕਿ ਆਪਾਂ ਚੜ੍ਹਾਈ ਚੜ੍ਹ ਕੇ ਜਾਣਾ ਏ ਤਾਂ ਆਪਾਂ ਪਹੁੰਚ ਹੀ ਜਾਵਾਂਗੇ ਸਾਨੂੰ ਪੌੜੀਆਂ ਥਾਣੀ ਨਹੀਂ ਜਾਣਾ ਚਾਹੀਦਾ ਸਾਨੂੰ ਚੜ੍ਹਾਈ ਚੜ੍ਹ ਕੇ ਜਾਣਾ ਚਾਹੀਦਾ ਕਿਉਂਕਿ ਚੜ੍ਹਾਈ ਚੜ੍ਹਨ ਨਾਲ ਇੱਕ ਤਾਂ ਸਾਡਾ ਸਾਹ ਸਹੀ ਰਹਿੰਦਾ ਏ ਪੌੜੀਆਂ ਨਾਲ ਹੌਲੀ ਹੌਲੀ ਆਉਂਦੇ ਵਕਤ ਸਾਨੂੰ ਪੌੜੀਆਂ ਨਾਲ ਆਉਣਾ ਚਾਹੀਦਾ ਜਾਣ ਲੱਗੇ ਸਾਨੂੰ ਚੜ੍ਹਾਈ ਚੜ੍ਹ ਕੇ ਜਾਣਾ ਚਾਹੀਦਾ ਉੱਥੋਂ ਦੇ ਮੰਦਰ ਯਾਤਰਾ ਬਹੁਤ ਵਧੀਆ ਕਈ ਲੋਕ ਦੂਰੋਂ ਦੂਰੋਂ ਆਣ ਕੇ ਜਾਂਦੇ ਹੈ ਓਕੇ ਜੀ